ਮੇਰਾ ਰਾਕੇਸ਼ ਸੁਜਾਨਪੁਰ ਦੀ ਵਸਨੀਕ ਜ਼ਿਲ੍ਹਾ ਪਠਾਨਕੋਟ ਔਰ ਐਸ ਐਮ ਐਸ ਟੀ ਰਾਜਪੂਤ ਸੀਨੀਅਰ ਸੈਕੈਂਡਰੀ ਸਕੂਲ ਦੇ ਵਿੱਚ ਪੜ੍ਹਾਉਂਦੀ ਹਾਂ ਅਤੇ ਮੈਂ ਮਿਡਏ ਮੀਲ ਦੀ ਜਾਣਕਾਰੀ ਬਾਰੇ ਬਹੁਤ ਵਧੀਆ ਢੰਗ ਦੇ ਨਾਲ ਜਾਣਕਾਰੀ ਰੱਖਦੀ ਹਾਂ ਮਿਡਏ ਮੀਲ ਉਹ ਸਕੀਮ ਹੈ ਜੋ ਬੱਚਿਆਂ ਨੂੰ ਜ਼ ਮਤਲਬ ਕਿ ਫਰੀ ਖਾਣਾ ਜੋ ਹੈ ਪ੍ਰੋਵਾਈਡ ਕੀਤਾ ਜਾਂਦਾ ਹੈ ਜਿਸਦੇ ਵਿੱਚ ਅਤੇ ਬੱਚਿਆਂ ਦੇ ਖਾਣੇ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਕੁਪੋਸ਼ਣ ਨਾ ਹੋਏ ਉਹਨਾਂ ਨੂੰ ਬਿਲਕੁਲ ਸੰਤੁਲਿਤ ਖੁਰਾਕ ਜੋ ਹੈ ਸਾਡੀ ਸਰਕਾਰ ਵਾਜੋਂ ਵੱਲੋਂ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਬਹੁਤ ਹੀ ਸਾਫ ਢੰਗ ਦੇ ਨਾਲ ਮਿਡਏ ਮੀਲ ਤਿਆਰ ਕਰਕੇ ਖਵਾਇਆ ਜਾਂਦਾ ਹੈ ਜਿਸ ਦੇ ਵਿੱਚ ਸਾਡੇ ਕੋਲ ਪੰਜ ਛੇ ਕੁੱਕ ਹੁੰਦੀਆਂ ਹਨ ਜਾਂ ਹੁੰਦੇ ਹਨ ਜੋ ਕਿ ਮਿਡਏ ਮੀਲ ਤਿਆਰ ਕਰਦੇ ਹਨ ਅਤੇ ਜੋ ਵੀ ਉਹਨਾਂ ਦਾ ਮੀਨੂ ਰੱਖਿਆ ਹੁੰਦਾ ਹੈ ਸੋਮਵਾਰ ਮੰਗਲਵਾਰ ਬੁੱਧਵਾਰ ਪੂਰੇ ਹਫਤੇ ਦੇ ਵਿੱਚ ਉਸ ਮੀਨੋ ਦੇ ਹਿਸਾਬ ਦੇ ਨਾਲ ਮੀਲ ਜੋ ਹੈ ਤਿਆਰ ਕੀਤੀ ਜਾਂਦੀ ਹੈ ਸਾਫ ਸੁਥਰਾ ਮੀਲ ਤਿਆਰ ਕਰਕੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਅੱਧੀ ਛੁੱਟੀ ਵੇਲੇ ਬੱਚਿਆਂ ਨੂੰ ਖਾਣੇ ਦੇ ਰੂਪ ਵਿੱਚ ਖਵਾ ਦਿੱਤਾ ਜਾਂਦਾ ਹੈ ਔਰ ਜਿਸ ਦੇ ਵਿੱਚ ਬੱਚਿਆਂ ਨੂੰ ਅੱਜ ਕੱਲ੍ਹ ਤਾਂ ਫਰੂਟ ਵਗੈਰਾ ਵੀ ਮਤਲਬ ਦਿੱਤੇ ਜਾਂਦੇ ਹਨ ਤਾਂ ਇਹ ਬਹੁਤ ਜਿਹੜੀ ਸਕੀਮ ਹੈ ਸੈਂਟਰਲ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ ਅਤੇ ਅੱਜ ਇਹ ਜਿਹੜੀ ਸਕੀਮ ਸ਼ੁਰੂ ਕੀਤੀ ਗਈ ਹੈ ਸੈਂਟਰਲ ਗਵਰਨਮੈਂਟ ਵੱਲੋਂ ਇਹ ਕਾਮਯਾਬ ਹੈ ਅਤੇ ਬਹੁਤ ਸਾਰੇ ਗਰੀਬ ਬੱਚਿਆਂ ਦਾ ਪੇਟ ਫੀਸ ਦੇ ਨਾਲ ਭਰਦਾ ਹੈ ਅਤੇ ਬੱਚੇ ਜੋ ਹਨ ਕੁਪੋਸ਼ਣ ਦੇ ਸ਼ਿਕਾਰ ਵੀ ਨਹੀਂ ਹੁੰਦੇ ਅਤੇ ਬੱਚਿਆਂ ਨੂੰ ਇੱਕ ਵਧੀਆ ਮੀਲ ਜੋ ਹੈ ਇੱਕ ਟਾਈਮ ਬਹੁਤ ਵਧੀਆ ਮੀਲ ਜੋ ਹੈ ਸਕੂਲ ਵੱਲੋਂ ਦਿੱਤਾ ਜਾਂਦਾ ਹੈ ਇਹ ਬਹੁਤ ਹੀ ਵਧੀਆ ਕੰਮ ਹੈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਅਤੇ ਸਕੂਲ ਵੱਲੋਂ ਬੱਚਿਆਂ ਨੂੰ ਜੋ ਫਰੀ ਖਾਣਾ ਦਿੱਤਾ ਜਾਂਦਾ ਹੈ ਇਸ ਵਾਸਤੇ ਬਹੁਤ ਬਹੁਤ ਧੰਨਵਾਦ